ਹੈਲੋ

ਸਤਿ ਸ਼੍ਰੀ ਅਕਾਲ ਜੀ ਮੱਖਣ ਸਿੰਘ ਗੱਲ ਕਰਦੇ ਆ ਜੀ ਹਾਂਜੀ ਅਤੇ ਮੈਂ ਸਰ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ ਅਸੀਂ ਆਪਣਾ

ਕੈਟ ਕੈਟਰਿੰਗ ਸਰਵਿਸ ਤੋਂ ਬੋਲਦੇ ਆ ਤੁਸੀਂ ਹਾਂਜੀ ਅਤੇ ਸਰ ਮੇਰੀ ਬੇਟੀ ਦੀ ਸ਼ਾਦੀ ਹੈ ਜੀ ਅਤੇ ਅਸੀਂ ਫੂਡ ਡਿਲੀਵਰ ਕਰਵਾਉਣਾ ਸੀ ਜੀ ਹਾਂਜੀ ਅਤੇ ਸੌਹਾ ਅਤੇ ਸੌ ਕੁ ਬੰਦਿਆਂ ਦਾ ਅਰੇਂਜਮੈਂਟ ਆ ਜੀ ਹਾਂਜੀ ਹਾਂਜੀ ਸ ਤੁਸੀਂ ਦੱਸੋ ਜੀ ਅਤੇ ਤੁਸੀਂ ਕੀ ਕੀ ਰੱਖਦੇ ਹੋ ਥਾਲੀ ਦੇ ਵਿੱਚ ਹਾਂਜੀ ਓਕੇ ਜੀ ਅਤੇ ਤੁਸੀਂ ਅਤੇ ਮਿੱਠਾ ਕੀ ਪਾਓਂਗੇ ਇਹਦੇ ਵਿੱਚ ਹਾਂਜੀ ਖੀਰ ਵਗੈਰਾ ਜੀ ਖੀਰ ਵਗੈਰਾ ਖੀਰ ਖੀਰ ਓਕੇ ਜੀ ਠੀਕ ਆ ਜੀ ਅਤੇ ਅਸੀਂ ਸਰ ਤੁਹਾਨੂੰ ਦੱਸ ਦਈਏ ਕਿ ਅਸੀਂ ਸੌ ਬੰਦਿਆਂ ਦਾ ਅਰੇਂਜਮੈਂਟ ਕਰਨਾ ਅਤੇ ਤੁਸੀਂ ਓਹ ਹਿਸਾਬ ਨਾਲ ਸਰ ਥਾਲੀ ਕਰ ਦਿਓ ਹਾਂਜੀ ਓਕੇ ਜੀ ਹਾਂਜੀ ਠੀਕ ਆ ਸਰ ਠੀਕ ਆ ਓਕੇ ਸਰ ਅਸੀਂ ਤੁਹਾਨੂੰ ਫੈਮਲੀ ਨਾਲ ਸਲਾਹ ਕਰਕੇ ਦੱਸ ਦਿੰਦੇ ਆ ਜੀ

ਠੀਕ ਆ ਸਰ